ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਡਿਫੈਕਟਿਵ ਆ ਗਿਆ ਅੱਛਾ ਉਹ ਤਾਂ ਕਲ ਉਹ ਤਾਂ ਕਲਰ ਕਲਰ ਦੀ ਦਿੱਕਤ ਹੋਈ ਹੈ ਨਾ ਜੀ ਡਿਫੈਕਟਿਵ ਤਾਂ ਨੀਗਾ ਹਾਂਜੀ ਕੋ ਕੋਈ ਗੱਲ ਨਹੀਂ ਤੁਸੀਂ ਇਹ ਦੀ ਕੋਈ ਵੀਡੀਓ ਬਣਾਈ ਹੈ ਓਪਨ ਕਰਦੇ ਹੋਏ ਦੀ ਹਮੇਸ਼ਾ ਵਾਸਤੇ ਧਿਆਨ ਰੱਖਿਆ ਕਰੋ ਜਦੋਂ ਪਹਿਲਾਂ ਤੁਸੀਂ ਪਾਰਸਲ ਆਪਣਾ ਓਪਨ ਕਰਦੇ ਹੋ ਨਾ ਉਹਨਾਂ ਦੀ ਇੱਕ ਵੀਡੀਓ ਬਣਾਇਆ ਕਰੋ ਵੀਡੀਓ ਬਣਾਉਂਦੇ ਹੋਏ ਨਾ ਪਤਾ ਲੱਗ ਜਾਂਦਾ ਵੀ ਇਹ ਪਰੂਫ ਹੋ ਜਾਂਦਾ ਹੈ ਪੱਕਾ ਫਿਰ ਅਸੀਂ ਉਸ ਚੀਜ ਨੂੰ ਸੱਚ ਮੰਨ ਲੈਂਦੇ ਹਾਂ ਨਹੀਂ ਤਾਂ ਅਸੀਂ ਐਂਵੇ ਸੱਚ ਨਹੀਂ ਮੰਨਦੇ ਗੇ ਹਾਂ ਹੁਣ ਪਾ ਦਉਗੇ ਤਾਂ ਉਹ ਗੱਲ ਵੱਖਰੀ ਹੈ ਚੱਲੋ ਕੋਈ ਗੱਲ ਨਹੀਂ ਜੀ ਤੁਸੀਂ ਇਹਦੀ ਪੇਮੈਂਟ ਕਿਵੇਂ ਕੀਤੀ ਹੋਈ ਹੈ ਕੈਸ਼ ਓਨ ਡਿਲੀਵਰੀ ਕੀਤੀ ਹੈ ਕੋਈ ਗੱਲ ਨਹੀਂ ਇਹ ਦਾ ਤੁਸੀਂ ਅਕਾਊਟ ਨੰਬਰ ਪੁਆ ਕੇ ਆਪਣਾ ਰਿਟਰਨ ਪਾ ਦਿਓ